ਨਮਸਕਾਰ ਸਰ ਜੀ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਸਰ ਅਸੀਂ ਸਮੂਹ ਪਰਿਵਾਰ ਪਰਿਵਾਰ ਅੰਮ੍ਰਿਤਸਰ ਹਰਿਮੰਦਰ ਸਾਹਿਬ ਜਾ ਰਹੇ ਹਾਂ ਅਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਕੋਲੋਂ ਇੱਕ ਗੱਡੀ ਕਰਾ ਬੁੱਕ ਕਰਵਾਉਣੀ ਹੈ ਅਸੀਂ ਕੁੱਲ ਛੇ ਪਰਿਵਾਰ ਵਾਸੀ ਹਾਂ ਮੈਂ ਮੇਰੇ ਪਤੀ ਅਤੇ ਮੇਰੇ ਬੱਚੇ ਅਸੀਂ ਸਵੇਰੇ ਅੱਠ ਵਜੇ ਨਿਕਲਣਾ ਹੈ ਅਤੇ ਇਹ ਪੂਰਾ ਇੱਕ ਦਿਨ ਦਾ ਟੂਰ ਹੋਵੇਗਾ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੀ ਹਾਂ ਕਿ ਇਹ ਤੁਹਾਡੇ ਗੱਡੀ ਦੇ ਕੀ ਰੇਟ ਹਨ ਕਿਵੇਂ ਜਿਵੇਂ ਕਿ ਜੇ ਅਸੀਂ ਛੋਟੀ ਗੱਡੀ ਕਰਵਾਉਣੀ ਹੋਵੇ ਤਾਂ ਕਿੰਨਾ ਖਰਚਾ ਆਵੇਗਾ ਅਤੇ ਜੇਕਰ ਵੱਡੀ ਗੱਡੀ ਜਿਵੇਂ ਕਿ ਇਨੋਵਾ ਫਿਰ ਕਿੰਨਾ ਖਰਚਾ ਆਵੇਗਾ ਸਾਡਾ ਸਾਡਾ ਤਿੰਨ ਹਜ਼ਾਰ ਤੱਕ ਖਰਚਾ ਹੋਵੇ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਨੂੰ ਇਸ ਰੇਟ ਵਿੱਚ ਵਧੀਆ ਗੱਡੀ ਕਰਕੇ ਦਿਓ ਧੰਨਵਾਦ